ਹੈਲੋ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਨਾ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕੋਲਜ 'ਚ ਐਡਮੀਸ਼ਨ ਲੈਣੀ ਸੀ ਅਤੇ ਸਰ ਮੈਂ ਬਾਹਰ ਤੋਂ ਸੀਗਾ ਤੁਸੀਂ ਮੈਨੂੰ ਦੱਸ ਸਕਦੇ ਓਂ ਇੱਥੇ ਪਲੱਸ ਟੂ ਤੋਂ ਬਾਅਦ ਕਿਹੜੇ ਕਿਹੜੇ ਕੋਰਸ 'ਤੇ ਸਕੋਲਰਸ਼ਿਪ ਕਿਹੜੀ ਕਿਹੜੀ ਲੱਗ ਸਕਦੀ ਮੈਨੂੰ ਅਤੇ ਇਹ 'ਚ ਬੈਨੀਫਿਟ ਹੋਣਗੇ ਸਰ ਮੇਰੇ ਇੱਥੇ

ਹਾਂਜੀ ਹਾਂਜੀ ਹਾਂਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਠੀਕ ਹੈ ਸਰ ਹਾਂਜੀ

ਠੀਕ ਹੈ ਥੈਂਕ ਥੈਂਕ ਯੂ